ਪੰਜਾਬੀ ਭਾਸ਼ਾ ਸਾਡੇ ਰਾਜ ਖੇਤਰ ਦੀ ਭਾਸ਼ਾ ਤੋਂ ਬਹੁਤ ਵੱਖਰੀ ਹੈ ਇਹ ਸਾਡੀ ਮਾਂ ਬੋਲੀ ਹੈ ਸਾਨੂੰ ਸਾਰੀਆਂ ਭਾਸ਼ਾਵਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਪਰ ਇਹ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਇਹ ਹੁਣ ਬੇਝਿਜਕਿਆਂ ਬੋਲਣੀ ਚਾਹੀਦੀ ਹੈ ਸਿੱਧੂ ਮੂਸੇ ਵਾਲੇ ਨੇ ਜਿਵੇਂ ਪੰਜਾਬੀ ਗਾਣੇ ਮਾਲਵੇ ਤੋਂ ਉੱਠ ਕੇ ਪੂਰੀ ਦੁਨੀਆਂ ਵਿੱਚ ਫੇਮਸ ਕਰ ਦਿੱਤੇ ਅਤੇ ਅੱਜ ਗੋਰੇ ਵੀ ਪੰਜਾਬੀਆਂ ਦੇ ਅਤੇ ਪੰਜਾਬੀ ਬੋਲੀ ਦੇ ਫੈਨ ਹਨ ਕਈ ਹੋਰ ਸਿੰਗਰਾਂ ਨੇ ਪੰਜਾਬੀ ਭਾਸ਼ਾ ਨੂੰ ਬਹੁਤ ਉੱਚ ਪੱਧਰ ਤੱਕ ਪਹੁੰਚਾਇਆ ਹੁਣ ਅਸੀਂ ਬੇਝਿਜਕ ਕਿਸੇ ਦੇ ਅੱਗੇ ਪੰਜਾਬੀ ਆਪਣੇ ਮਾਣ ਨਾਲ ਬੋਲ ਸਕਦੇ ਹਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਹ ਗੁਰਮੁਖੀ ਵਿੱਚ ਹੈ ਪੰਜਾਬੀ ਬੋਲੀ ਬਹੁਤ ਹੀ ਵਧੀਆ ਹੈ ਕਈ ਬਾਹਰਲੇ ਮੁਲਕਾਂ ਦੇ ਲੋਕ ਪੰਜਾਬੀ ਗਾਣੇ ਅਤੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਬਹੁਤ ਪਸੰਦ ਕਰਦੇ ਹਨ ਪੰਜਾਬ ਪੰਜਾਬੀ ਪੱਗਾਂ ਬੰਨਦੇ ਹਨ ਅਤੇ ਗੋਰੇ ਵੀ ਪੱਗਾਂ ਦਾ ਬਹੁਤ ਮਾਣ ਕਰਦੇ ਹਨ ਅਤੇ ਪੱਗਾਂ ਨੂੰ ਆਪਣੇ ਸਿਰ 'ਤੇ ਸਜਾਉਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਪੱਗਾਂ ਬਹੁਤ ਵਧੀਆ ਲੱਗਦੀਆਂ ਹਨ ਸਾਡੀ ਸਾਰੀ ਭਾਸ਼ਾ ਰਿਸਪੈਕਟ ਸਾਡੀ ਸਾਰੀਆਂ ਭਾਸ਼ਾਵਾਂ ਲਈ ਬਹੁਤ ਰਿਸਪੈਕਟ ਹੈ